ਸਾਡਾ ਧਰਮ ਸਾਨੂੰ ਸਮਾਜ ਵਿੱਚ ਸੇਵਾ ਵਾਸਤੇ ਬਹੁਤ ਵੱਡੀ ਸਿੱਖਿਆ ਦਿੰਦਾ ਹੈ ਕਿਉਂਕਿ ਸਾਡਾ ਧਰਮ ਸਾਨੂੰ ਦੱਸਦਾ ਹੈ ਕਿ ਕਿਸੇ ਦਾ ਬੁਰਾ ਨਹੀਂ ਕਰਨਾ ਅਤੇ ਜੇ ਕੋਈ ਮੁਸ਼ਕਿਲ ਵਿੱਚ ਹੈ ਅਤੇ ਉਹਦੀ ਆਪਾਂ ਹੈਲਪ ਕਰਨੀ ਹੈ ਉਹਦੀ ਸਾਂਭ ਸੰਭਾਲ ਕਰਨੀ ਹੈ ਅਤੇ ਜਦੋਂ ਵੀ ਕੋਈ ਕਿਤੇ ਸਾਨੂੰ ਰਸਤੇ ਵਿੱਚ ਜਾਂ ਆਸੇ ਪਾਸੇ ਕਿਤੇ ਕੋਈ ਐਕਸੀਡੈਂਟ ਜਾਂ ਐਰਾ ਵਗੈਰਾ ਕੁਛ ਵੀ ਹੈ ਅਤੇ ਸਾਡਾ ਧਰਮ ਸਾਨੂੰ ਇਹ ਦੱਸਦਾ ਕਿ ਉਸ ਬੰਦੇ ਦੀ ਮਦਦ ਕਰਨੀ ਹੈ ਜੋ ਵੀ ਮੁਸ਼ਕਿਲ ਦੇ ਵਿੱਚ ਹੈ ਅਤੇ ਸਾਡੇ ਸਮਾਜ ਦੇ ਵਿੱਚ ਸਾਨੂੰ ਸਾਡੇ ਗੁਰੂਆਂ ਨੇ ਦੱਸਿਆ ਹੈ ਕਿ ਗਰੀਬਾਂ ਦੀ ਮਦਦ ਕਰਨੀ ਹੈ ਲੋੜਵੰਦਾਂ ਵਾਸਤੇ ਲੰਗਰ ਲਗਾਉਣੇ ਨੇ ਜੇ ਕਿਸੇ ਕੋਲ ਕੱਪੜੇ ਨਹੀਂ ਆ ਉਹਨੂੰ ਕੱਪੜੇ ਦੇਣੇ ਨੇ ਜੇ ਕਿਸੇ ਨੂੰ ਦਵਾਈ ਦੀ ਲੋੜ ਹੈ ਅਤੇ ਸਾਨੂੰ ਉਹਨਾਂ ਨੂੰ ਦਵਾਈ ਜ਼ਰੂਰੀ ਦੇਣੀ ਪੈਂਦੀ ਹੈ ਕਿਉਂਕਿ ਅਸੀਂ ਕਿਸੇ ਦੇ ਔਖੇ ਵੇਲੇ ਕੰਮ ਆ ਸਕੀਏ ਸਾਡਾ ਧਰਮ ਸਾਨੂੰ ਸਿਖਾਉਂਦਾ ਹੈ